ਹੈਲੋ ਸਤਿ ਸ਼੍ਰੀ ਅਕਾਲ ਸਰ ਸਰ ਤੁਸੀਂ ਵਿਸ਼ਾਲ ਸਰ ਬੋਲਦੇ ਪਏ ਹੋ ਤਰਨ ਤਾਰਨ ਤੋਂ ਹਾਂਜੀ ਸਰ ਮੈਨੂੰ ਨਾ ਮੇਰੀ ਫਰੈਂਡ ਨੇ ਦੱਸਿਆ ਸੀ ਤੁਹਾਡੇ ਬਾਰੇ ਅਤੇ ਮੈਂ ਮਤਲਬ ਤਰਨ ਤਾਰਨ ਆਉਣਾ ਚਾਹੁੰਦੀ ਹਾਂ ਮਤਲਬ ਤਰਨ ਤਰਨ ਵਿਜਿਟ ਕਰਨਾ ਚਾਹੁੰਦੀ ਹਾਂ ਅਤੇ ਪਲੀਜ਼ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਕਿਹੜਾ ਮੌਸਮ ਸਹੀ ਰਹੇਗਾ ਜਾਂ ਜਿਸ ਮੰਥ ਵਿੱਚ ਮੈਂ ਆਵਾਂ ਮਤਲਬ ਕਿ ਕੁਛ ਮੈਨੂੰ ਗਾਈਡ ਕਰੋਗੇ ਠੀਕ ਹੈ ਜੀ ਅੱਛਾ ਅੱਛਾ ਠੀਕ ਹੈ ਜੀ ਠੀਕ ਠੀਕ ਹੋਰ ਵੀ ਮਤਲਬ ਜੇ ਜਗ੍ਹਾ ਠੀਕ ਆ ਹੋਰ ਵੀ ਜਗ੍ਹਾ ਹੁੰਦੀਆਂ ਹੋਣੀਆਂ ਨਾ ਦੇਖਣ ਵਾਲੀਆਂ ਇੱਥੇ ਹੋਰ ਵੀ ਸ਼ਹਿਰ 'ਚ ਹੋਣੀਆਂ ਗੁਰਦੁਆਰਿਆਂ ਤੋਂ ਇਲਾਵਾ ਹਾਂਜੀ

ਹਾਂਜੀ ਮਤਲਬ ਇਤਿਹਾਸਿਕ ਹੀ ਹੋਣੀਆਂ ਹੈ ਨਾ ਇਤਿਹਾਸਿਕ ਗੁਰਦੁਆਰੇ ਹੋਣੇ ਆ ਅੱਛਾ ਜੀ ਠੀਕ ਹੈ ਜੀ ਹੋਰ ਵੀ ਮਤਲਬ ਬਹੁਤ ਸਾਰੀਆਂ ਜਗ੍ਹਾ ਮੈਂ ਦੇਖਣਾ ਚਾਹੁੰਦੀ ਹਾਂ ਵੀ ਕੀ ਤੁਸੀਂ ਮੇਰੀ ਹੈਲਪ ਕਰੋਗੇ ਠੀ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਅਤੇ ਫਿਰ ਮੈਂ ਚਲੋ ਗਰਮੀਆਂ ਦੇ ਮੌਸਮ ਵਿੱਚ ਮੈਂ ਆਪਣੀ ਜਿਹੜੀ ਆ ਪਲੈਨਿੰਗ ਕਰਾਂਗੀ ਆਉਣ ਦੀ ਅਤੇ ਮੈਂ ਤਾਂ ਫੋਨ ਕਰਾਂਗੀ ਅਤੇ ਆਪਾਂ ਵਿਜ਼ਿਟ ਕਰਾਂਗੇ ਠੀਕ ਹੈ ਜੀ ਥੈਂਕ ਯੂ ਸੋ ਮਚ ਓਕੇ ਜੀ ਬਾਏ